ਸਾਡੇ ਖੇਤਰ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਜਿਵੇਂ ਅਕਾਲੀਏ ਕਾਂਗਰਸੀਏ ਅਤੇ ਆਮ ਆਦਮੀ ਪਾਰਟੀ ਆਈ ਹੈ ਪਰ ਜੇ ਇਸ ਤੋਂ ਪਹਿਲਾਂ ਅਕਾਲੀਆਂ ਨੇ ਬਹੁਤ ਲੰਮਾ ਸਮਾਂ ਰਾਜ ਕੀਤਾ ਹੈ ਉਸ ਤੋਂ ਇਲਾਵਾ ਉਸ ਤੋਂ ਬਾਅਦ ਕਾਂਗਰਸ ਨੇ ਵੀ ਕਾਫ਼ੀ ਵਧੀਆ ਕੀਤਾ ਵ ਵਧੀਆ ਵਿਕਾਸ ਕੀਤਾ ਹੈ ਪਰ ਅੱਜ ਦੇ ਸਮੇਂ ਵਿੱਚ ਜੇ ਹੁਣ ਦੀ ਗੱਲ ਕਰੀਏ ਤਾਂ ਆਮ ਸਰਕਾਰ ਆਮ ਆਦਮੀ ਸਰਕਾਰ ਬਹੁਤ ਵਧੀਆ ਹੈ ਜੋ ਕਿ ਭਗਵੰਤ ਮਾਨ ਹੈ ਉਹਨਾਂ ਨੇ ਬਹੁਤ ਸਾਰੇ ਵਿਕਾਸ ਕੀਤੇ ਬਹੁਤ ਸਾਰੀਆਂ ਸੁੱਖ ਸੁਵਿਧਾ ਕੱਢੀਆਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਹਨ ਜਿਸ ਤਰ੍ਹਾਂ ਕਿ ਟੂਲ ਪਲਾਜੇ ਟੂਲ ਪਲਾਜੇ ਕਾਫ਼ੀ ਟੂਲ ਪਲਾਜੇ ਬੰਦ ਕਰਤੇ ਨੇ ਬੱਸਾਂ ਦੇ ਕਿਰਾਏ ਮਾਫ਼ ਨੇ ਕਈ ਇਸ ਤਰ੍ਹਾਂ ਦੀਆਂ ਸੁੱਖ ਸੁਵਿਧਾ ਨੇ ਜੋ ਸਾਨੂੰ ਵਧੀਆ ਮਿਲ ਰਹੀਆਂ ਨੇ ਜੇ ਕੀ ਮੈਂ ਮੇਰੀ ਗੱਲ ਕਰੀਏ ਤਾਂ ਮੈਂ ਇਹ ਚਾਹੁੰਦੀ ਹਾਂ ਕਿ ਸਾਰਿਆਂ ਨੂੰ ਹੀ ਹੁਣ ਵਾਲੀ ਜੋ ਸਰਕਾਰ ਹੈ ਉਹਦਾ ਵਧੀਆ ਵੱਧ ਤੋਂ ਵੱਧ ਸਮਰਥਨ ਕਰਨਾ ਚਾਹੀਦਾ ਹੈ ਜੋ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿਕਾਸ ਉਹ ਚੱਕ ਸਕੇ ਅੱਜ ਕੱਲ੍ਹ ਦੀ ਗੱਲ ਕਰੀਏ ਤਾਂ ਸਰਕਾਰੀ ਸਕੂਲ ਜੋ ਕਿ ਪ੍ਰਾਈਵੇਟ ਨੂੰ ਵੀ ਪਿੱਛੇ ਛੱਡ ਕੇ ਵਧੀਆ ਪੜ੍ਹਾਈ ਲਿਖਾਈ ਵਧੀਆ ਢੰਗ ਵਧੀਆ ਬਿਲਡਿੰਗਾਂ ਸਭ ਕੁਛ ਵਧੀਆ ਹੀ ਦਿੱਤਾ ਜਾ ਰਿਹਾ ਹੈ ਜੋ ਆਉਣ ਵਾਲ ਜੋ ਅੱਜ ਦੀ ਸਰਕਾਰ ਹੈ ਉਹਦੇ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਸਮਿਆਂ ਵਿੱਚ ਵਧੀਆ ਵਿਕਸਿਤ ਪੰਜਾਬ ਮਿਲ ਸਕੇ ਇਸ ਕਰਕੇ ਸਾਨੂੰ ਆਪਣੇ ਖੇਤਰ ਵਿੱਚ ਵਧੀਆ ਤੋਂ ਵਧੀਆ ਸਿਆਸੀ ਲੀਡਰ ਨੂੰ ਹੀ ਚੁਣਨਾ ਚਾਹੀਦਾ ਹੈ ਨਾ ਕਿ ਉਹ ਜੋ ਸਾਨੂੰ ਆਪਣੇ ਹੀ ਮਗਰ ਲਾ ਕੇ ਗਲਤ ਸਿੱਖਿਆ ਪਾਸੇ ਲੈ ਕੇ ਜਾਣ ਸਾਨੂੰ ਆਪਣੇ ਆਪਣੀ ਵੋਟ ਦਾ ਵਧੀਆ ਇਸਤੇਮਾਲ ਕਰਨਾ ਚ ਆਉਣਾ ਚਾਹੀਦਾ ਹੈ